ਪੰਜਾਬੀ ਸਾਡੀ ਮਾਤ ਭਾਸ਼ਾ ਹੈ ਮੈਂ ਤੁਹਾਨੂੰ ਪੰਜਾਬੀ ਬਾਰੇ ਦੱਸਣਾ ਚਾਹੁੰਦੀ ਹਾਂ ਜਿਵੇਂ ਕਿ ਪੰਜਾਬੀ ਆਪਣੇ ਸ਼ੁਰੂ ਤੋਂ ਹੀ ਚਲਦੀ ਆ ਰਹੇ ਹੈ ਛੋਟੇ ਬੱਚਿਆਂ ਨੂੰ ਵੀ ਪੰਜਾਬੀ ਆਪਾਂ ਘਰ ਵਿੱਚ ਹੀ ਸਿਖਾਉਂਦੇ ਹਾਂ ਪੰਜਾਬੀ ਆਪਣੀ ਭਾਸ਼ਾ ਹੈ ਪੰਜਾਬੀ ਨੂੰ ਆਪਾਂ ਭੁੱਲ ਨਹੀਂ ਸਕਦੇ ਪੰਜਾਬੀ ਸਗੋਂ ਅੱਗੇ ਵੀ ਵਧਣੀ ਚਾਹੀਦੀ ਹੈ ਜਿਵੇਂ ਕਿ ਪੰਜਾਬੀ ਸਕੂਲਾਂ ਵਿੱਚ ਇਤਿਹਾਸ ਵੀ ਪੰਜਾਬੀ ਵਿੱਚ ਹੀ ਹਨ ਜਿਵੇਂ ਕਿ ਗੁਰੂ ਸਾਹਿਬਾਨ ਬਾਰੇ ਵੀ ਪੰਜਾਬੀ ਵਿੱਚ ਹੀ ਲਿਖਿਆ ਗਿਆ ਹੈ ਸਾਨੂੰ ਸਕੂਲਾਂ ਦੇ ਵਿੱਚ ਪੰਜਾਬੀ ਟੀਚਰਾਂ ਨੂੰ ਸਿਖਾਉਣੀ ਚਾਹੀਦੀ ਹੈ ਜਿਵੇਂ ਕਿ ਕਵਿਤਾ ਵੀ ਪੰਜਾਬੀ ਵਿੱਚ ਹਨ ਸਕੂਲਾਂ ਵਿੱਚ ਲੈਕਚਰ ਪੰਜਾਬੀ ਵਿੱਚ ਹੀ ਡਿਗਰੀ ਕਾਲਜਾਂ ਵਿੱਚ ਵੀ ਲੈਕਚਰ ਦੇਣੇ ਚਾਹੀਦੇ ਹਨ ਪੰਜਾਬੀ ਬਾਰੇ ਸਾਨੂੰ ਸਾਰਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬੀ ਆਪਣੀ ਭਾਸ਼ਾ ਹੈ ਅਤੇ ਪੰਜਾਬੀ ਨੂੰ ਹੀ ਭੁੱਲਣਾ ਨਹੀਂ ਚਾਹੀਦਾ ਜਿਵੇਂ ਕਿ ਸਕੂਲਾਂ ਵਿੱਚ ਹੋਰ ਵੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅੰਗਰੇਜ਼ੀ ਹਿੰਦੀ ਆਪਾਂ ਇਹਨਾਂ ਨੂੰ ਵੀ ਸਿੱਖਣਾ ਪਸੰਦ ਕਰਦੇ ਹਾਂ ਇਹ ਆਪਾਂ ਨੂੰ ਬਹੁਤ ਹੀ ਲੋੜਦਾ ਹੈ ਪਰ ਇਹ ਕਿ ਪੰਜਾਬੀ ਆਪਾਂ ਭਾਸ਼ਾ ਜ਼ਰੂਰ ਸਿੱਖਣੀ ਹੈ ਅਤੇ ਸਕੂਲਾਂ ਵਿੱਚ ਵੀ ਚਾਹੀਦਾ ਹੈ ਕਿ ਪੰਜਾਬੀ ਬਾਰੇ ਹੀ ਜਾਣਕਾਰੀ ਦਿੱਤੀ ਜਾਵੇ ਅਪ ਪੰਜਾਬੀ ਭਾਸ਼ਾ ਆਪਾਂ ਕਦੇ ਵੀ ਇਸ ਇਸ ਤੋਂ ਮੁੱਖ ਨਹੀਂ ਮੋੜ ਸਕਦੇ ਪੰਜਾਬੀ ਆਪਾਂ ਨੂੰ ਮੁੱਢ ਤੋਂ ਹੀ ਸ਼ੁਰੂ ਤੋਂ ਹੀ ਮਿਲੀ ਹੋਈ ਹੈ ਪੰਜਾਬੀ ਭਾਸ਼ਾ ਆਪਾਂ ਕਦੇ ਵੀ ਭੁੱਲਣਾ ਨਹੀਂ ਪਸੰਦ ਕਰਾਂ